ਪਿੱਛੇ ਜਿਹੇ ਮੇਰੇ ਪਰਿਵਾਰ ਨੇ ਬਹੁਤ ਬੁਰਾ ਸਮਾਂ ਦੇਖਿਆ ਕਿਉਂਕਿ ਅਸੀਂ ਇੱਕ ਘਰ ਖਰੀਦਣਾ ਸੀ ਪਰ ਘਰ ਖਰੀਦਣ ਲਈ ਸਾਡੇ ਬੈਂਕ ਵਿੱਚ ਕੋਈ ਸੇਵਿੰਗ ਜਾਂ ਫਿਰ ਕੋਈ ਫੰਡ ਵਗੈਰਾ ਨਹੀਂ ਸੀ ਸਾਡੇ ਰਿਸ਼ਤੇਦਾਰਾਂ ਨੇ ਵੀ ਸਾਡੀ ਕੋਈ ਹੈਲਪ ਨਹੀਂ ਕੀਤੀ ਅਤੇ ਮੈਂ ਸੋਚਿਆ ਕਿ ਪਾਪਾ ਦੇ ਨਾਲ ਕ ਨਾਲ ਕੋਈ ਮੈਂ ਵੀ ਬਿਜ਼ਨਸ ਕਰ ਲਵਾਂ ਜਿਸ ਨਾਲ ਪੈਸੇ ਕਮਾਏ ਜਾ ਸਕਣ ਅਤੇ ਮੈਂ ਖੁਦ ਦੀ ਸੇਵਿੰਗ ਕਰਕੇ ਆਪਣੇ ਘਰਦਿਆਂ ਨੂੰ ਦੇ ਸਕਾਂ ਜਿਸ ਨਾਲ ਉਹ ਘਰ ਖਰੀਦ ਸਕਣ ਅਤੇ ਮੈਂ ਉਹਨਾਂ ਦੀ ਕੁਝ ਨਾ ਕੁਝ ਤਾਂ ਹੈਲਪ ਕਰ ਹੀ ਸਕਦੀ ਹਾਂ ਅਤੇ ਕੁਝ ਉਹਨਾਂ ਕੋਲ ਹੈਗੇ ਕੁਝ ਉਹ ਪੈਸੇ ਕਰ ਸਕਣ ਅਤੇ ਕੁਝ ਮੈਂ ਉਹਨਾਂ ਨੂੰ ਦੇ ਦਵਾਂ ਅਤੇ ਇਸ ਨਾਲ ਅਸੀਂ ਆਪਦਾ ਘਰ ਖਰੀਦ ਸਕੀਏ ਅਤੇ ਇਸ ਨਾਲ ਮੈਂ ਆਪਦਾ ਬਿਜਨਸ ਸ਼ੁਰੂ ਕੀਤਾ ਜਿਸ ਨਾਲ ਮੈਂ ਕੁਝ ਵਧੀਆ ਪੈਸੇ ਕਮਾ ਲਏ ਅਤੇ ਮੈਂ ਆਪਣੇ ਘਰਦਿਆਂ ਨੂੰ ਦਿੱਤੇ ਜਿਸ ਨਾਲ ਅਸੀਂ ਘਰ ਖਰੀਦ ਸਕੇ